ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਨਾਲ ਅਮਨਪ੍ਰੀਤ ਕੌਰ ਮੈਂ ਤੁਹਾਨੂੰ ਪਾਣੀ ਦੇ ਨੀਚੇ ਜਾਣ ਦੇ ਕਾਰਨ ਦੱਸ ਸਕਦੀ ਹਾਂ ਜਿਸ ਕਾਰਨ ਅਸੀਂ ਪਾਣੀ ਨੂੰ ਬਹੁਤ ਜ਼ਿਆਦਾ ਵਿਅਰਥ ਗੁਆਉਂਦੇ ਹਾਂ ਜਿਵੇਂ ਕਿ ਅਸੀਂ ਟੂਟੀਆਂ ਖੁੱਲ੍ਹੀਆਂ ਛੱਡ ਦਿੰਦੇ ਹਾਂ ਕਈ ਵਾਰ ਬਾਗ਼ ਵਿੱਚ ਪੌਦਿਆਂ ਨੂੰ ਇੱਦਾਂ ਹੀ ਪਾਣੀ ਛੱਡ ਕੇ ਲੋਕ ਚਲੇ ਜਾਂਦੇ ਹਨ ਜਿਸ ਨਾਲ ਪਾਣੀ ਦੀ ਬਹੁਤ ਬੇਅਦਬੀ ਹੁੰਦੀ ਹੈ ਪਾਣੀ ਦੀ ਬੇਅਦਬੀ ਹੋਣ ਕਾਰਨ ਸਾਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਾਣੀ ਨਹੀਂ ਮਿਲ ਸਕਦਾ ਪਾਣੀ ਨਾ ਮਿਲਣ ਕਾਰਨ ਸਾਨੂੰ ਬਹੁਤ ਮੁਸ਼ਕਿਲ ਆਵੇਗੀ ਸਾਡੇ ਨਾਲ ਦੇ ਪਿੰਡ ਕਈ ਪਿੰਡਾਂ ਵਿੱਚ ਪਾਣੀਆਂ ਦੀ ਬਹੁਤ ਕਮੀ ਆ ਚੁੱਕੀ ਹੈ ਜਿਸ ਕਾਰਨ ਸਾਨੂੰ ਪਾਣੀ ਦੀ ਸੰਭਾਲ ਕਰਨੀ ਚਾਹੀਦੀ ਹੈ ਪਾਣੀ ਵਿਅਰਥ ਨਹੀਂ ਗਵਾਉਣਾ ਚਾਹੀਦਾ ਜੇਕਰ ਅਸੀਂ ਕੋਈ ਵੀ ਕਿਸੇ ਵੀ ਜਗ੍ਹਾ ਪਾਣੀ ਨੂੰ ਖੁੱਲ੍ਹਾ ਵੇਖਦੇ ਹਾਂ ਤਾਂ ਸਾਨੂੰ ਉੱਥੇ ਨਲ ਟੂਟੀ ਕੁਛ ਵੀ ਹੋਵੇ ਉਸਨੂੰ ਬੰਦ ਕਰਨਾ ਚਾਹੀਦਾ ਹੈ ਪਾਣੀ ਨੂੰ ਵਿਅਰਥ ਨਹੀਂ ਗਵਾਉਣਾ ਚਾਹੀਦਾ ਜਲ ਹੈ ਤਾਂ ਕੱਲ੍ਹ ਹੈ ਜੇ ਇਹ ਗੱਲ ਆਪਾਂ ਨਾਲ ਲੈ ਕੇ ਚੱਲਾਂਗੇ ਤਾਂ ਅਸੀਂ ਪਾਣੀ ਦੀ ਬੇਅਦਬੀ ਨੂੰ ਰੋਕ ਸਕਦੇ ਹਾਂ ਪਾਣੀ ਦੇ ਘੱਟਦੇ ਜਾ ਰਹੇ ਦਾ ਕਾਰਨ ਅਸੀਂ ਹੋ ਹਾਂ ਅਸੀਂ ਹ ਅਸੀਂ ਉਹ ਫਸਲਾਂ ਉਗਾਉਂਦੇ ਹਾਂ ਜਿਹਨਾਂ ਵਿੱਚ ਪਾਣੀ ਦੀ ਜ਼ਿਆਦਾ ਵਰਤੋਂ ਹੁੰਦੀ ਹੈ ਫਸਲਾਂ ਵਿੱਚ ਪਾਣੀ ਵਿੱਚ ਸਪਰੇਹਾਂ ਰੇਹਾਂ ਸਪਰੇਹਾਂ ਨੂੰ ਮਿਲਾ ਕੇ ਵੀ ਛਿੜਕਾਅ ਕੀਤਾ ਜਾਂਦਾ ਹੈ ਜਿਸ ਕਾਰਨ ਫਸਲਾਂ ਨੂੰ ਪਾਣੀ ਦੀ ਜ਼ਿਆਦਾ ਲੋੜ ਹੁੰਦੀ ਹੈ ਜਿਸ ਕਾਰਨ ਪਾਣੀ ਘੱਟਦਾ ਜਾ ਰਿਹਾ ਹੈ ਸਾਨੂੰ ਉਹ ਵਾਲੀਆਂ ਫਸਲਾਂ ਬੀਜਣੀਆਂ ਚਾਹੀਦੀਆਂ ਹਨ ਜਿਸ ਵਿੱਚ ਪਾਣੀ ਦੀ ਵਰਤੋਂ ਘੱਟ ਹੁੰਦੀ ਹੈ